ਮਾਈਗਰੇਸ਼ਨ ਕਰਕੇ ਪੰਜਾਬ ਦੇ ਕਾਰੋਬਾਰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਜਿੰਨੀਆਂ ਵੀ ਪੰਜਾਬ ਦੇ ਪੈਸੇ ਵਾਲੇ ਲੋਕ ਹਨ ਉਹ ਪੰਜਾਬ ਛੱਡ ਕੇ ਕਨੇਡਾ ਜਾ ਰਹੇ ਹਨ ਸਰਕਾਰ ਦੀਆਂ ਨੀਤੀਆਂ ਕਰਕੇ ਅਤੇ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਇੱਥੇ ਕੋਈ ਵੀ ਮਿੱਲ ਨਹੀਂ ਲੱਗ ਰਹੀ ਜੇਕਰ ਅਸੀਂ ਕੋਈ ਵੀ ਕਾਰੋਬਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਮਾਈਗਰੇਸ਼ਨ ਪੰਜਾਬ ਤੋਂ ਬਾਹਰ ਜਾ ਰਹੇ ਹਨ ਕਿਸੇ ਨਾ ਕਿਸੇ ਤਰੀਕੇ ਰੋਕਣਾ ਚਾਹੀਦਾ ਹੈ ਜਾਂ ਸਰਕਾਰ ਉਹਨਾਂ ਨੂੰ ਨਵੀਆਂ ਸਕੀਮਾਂ ਦੇਵੇ ਤਾਂ ਜੋ ਆਪਣੇ ਕਾਰੋਬਾਰ ਨੂੰ ਵਧਾ ਸਕਣ